ਦੌੜਨ ਨਾਲ ਕਾਫੀ ਸਾਡਾ ਬੈਨੀਫਿਟ ਆ ਸਾਡਾ ਫਾਇਦਾ ਵਾ ਜਿਹੜੇ ਪਰ ਇੱਕ ਤਾਂ ਚਲੋ ਸਰੀਰ ਦੀ ਜਿਹੜੀ ਗੰਦਗੀ ਬਾਹਰ ਨਿਕਲ ਜਾਂਦੀ ਹੈ ਪਸੀਨੇ ਰਸਤੇ ਬਿਮਾਰੀਆਂ ਤੋਂ ਬੰਦਾ ਦੂਰ ਰਹਿੰਦਾ ਦੌੜਨ ਦੇ ਨਾਲ ਕਾਫੀ ਸਟੈਮਿਨਾ ਬੰਦੇ ਦਾ ਬਣਿਆ ਰਹਿੰਦਾ ਦੌੜਣ ਨਾਲ ਬੰਦਾ ਨਿਰੋਗੀ ਰਹਿੰਦਾ ਵਾ ਰੋਗ ਚਲੋ ਕਈ ਇੱਕ ਤਾਂ ਮਾਨਸਿਕ ਅਤੇ ਦਿਮਾਗੀ ਤੌਰ 'ਤੇ ਉਹ ਠੀਕ ਰਹਿੰਦਾ ਬੰਦਾ ਕਿਉਂਕਿ ਐਕਸਾਈਜ਼ ਕਰਦਾ ਜਿਹੜਾ ਬੰਦਾ ਉਹਦਾ ਦਿਮਾਗ ਫਰੈਸ਼ ਰਹਿੰਦਾ ਟੈਂਸ਼ਨ ਤਾਂ ਚਲੋ ਇੱਕ ਗੱਲ ਹੈ ਨਾ ਉਂਝ ਜਿੱਦਾਂ ਕਿ ਡਿਪਰੈਸ਼ਨ 'ਚ ਜਾਂਦੇ ਕਈ ਲੋਕ ਇਹੋ ਜਿਹਾ ਕੰਮ ਕੋਈ ਨਹੀਂ ਹੁੰਦਾ ਜਿਹੜਾ ਬੰਦਾ ਦੌੜ ਦਾੜ ਲਾਉਂਦਾ ਦੌੜਨ ਦੇ ਕਈ ਫਾਇਦੇ ਨੇ ਅਤੇ ਸਿਹਤ ਜਿਹੜੀ ਉਹ ਵਾਕੇ ਤੰਦਰੁਸਤ ਰਹਿਣੀ ਆ ਕਿਉਂਕਿ ਜਦੋਂ ਦੌੜਨਾ ਬੰਦੇ ਨੇ ਅਤੇ ਠੀਕ ਰਹਿਣਾ ਸਾਰਾ ਸਿਸਟਮ ਵਧੀਆ ਹੁੰਦਾ ਦੌੜਨ ਦੇ ਨਾਲ ਇੱਦਾਂ ਹੀ ਚੱਲਦਾ ਰਹਿੰਦਾ ਸਾਰਾ ਦੌੜੋ ਰਨਿੰਗ ਕਰੋ ਸਵੇਰੇ ਸ਼ਾਮ ਤਾਜ਼ੀ ਹਵਾ ਫੇਫੜਿਆਂ ਨੂੰ ਜਾਣੀ ਹੈ ਨਾ ਫੇਫੜਿਆਂ ਨੂੰ ਤਾਜ਼ੀ ਹਵਾ ਮਿਲਣੀ ਪੰਪਿੰਗ ਹੋਣੀ ਆ ਫੇਫੜਿਆਂ 'ਚ ਜਿਹੜੀ ਅੰਦਰ ਸ ਡਾਇਰੈਕਟ ਹਵਾ ਜਾਣੀ ਜਾ ਗੰਦ ਉਹ ਜਿਹੜੀ ਤੁਹਾਡੀ ਉਹ ਦੂਜੀ ਹਵਾ ਬਾਹਰ ਨਿਕਲਣੀ ਆ ਤਾਜ਼ੀ ਹਵਾ ਅੰਦਰ ਜਾਣੀ ਫੇਫੜਿਆਂ ਨੂੰ ਉਹ ਉਹ ਮਿਲਦੀ ਆ ਮਜ਼ਬੂਤੀ ਮਿਲਦੀ ਆ ਹੋਰ ਪਾਵਰ ਮਿਲਦੀ ਆ ਅਤੇ ਰੋਗ ਲਾਗੇ ਨਹੀਂ ਵੱਜਦਾ ਇੰਨੀ ਛੇਤੀ ਕੋਈ ਵੀ ਧੰਨਵਾਦ ਜੀ